ਸਾਡੇ ਪਿੰਡ ਵਿੱਚ ਲਾਇਬ੍ਰੇਰੀ ਨਹੀਂ ਸੀ ਹੈਗੀ ਆ ਪਰ ਅਸੀਂ ਸਕੂਲਾਂ ਤੋਂ ਆਪਣੇ ਸਕੂਲ ਅਤੇ ਲਾਈਬ੍ਰੇਰੀ ਵਿੱਚੋਂ ਕਿਤਾਬਾਂ ਲਿਆ ਕੇ ਆਪਣੇ ਘਰ ਵਿੱਚ ਲੈ ਕੇ ਅਸੀਂ ਪੜ੍ਹਦੇ ਹੁੰਦੇ ਸੀਗੇ ਪਰ ਅਸੀਂ ਆਪਣੇ ਸਕੂਲ ਅਤੇ ਕੋਲੇਜ ਵਿੱਚੋਂ ਟੀਚਰਾਂ ਨੂੰ ਕਹਿ ਕੇ ਪ੍ਰਿੰਸੀਪਲ ਮੈਮ ਨੇ ਉਹਨਾਂ ਨੂੰ ਮਤਲਬ ਕਿ ਅੱਗੇ ਸਰਪੰਚ ਵਗੈਰਾ ਨੂੰ ਕਹਿ ਕੇ ਸਾਡੇ ਪਿੰਡ ਵਿੱਚ ਇੱਕ ਲਾਇਬ੍ਰੇਰੀ ਬਣਵਾਈ ਹੈ ਉੱਥੇ ਹੁਣ ਸਾਰੇ ਪਿੰਡ ਦੇ ਲੋਕ ਹੋਰ ਵੀ ਇਲਾਕਿਆਂ ਤੋਂ ਆਉਂਦੇ ਆ ਅਤੇ ਲਾਇਬ੍ਰੇਰੀ ਵਿੱਚੋਂ ਕਈ ਉਹਨਾਂ ਉਹ ਹਰ ਇੱਕ ਤਰ੍ਹਾਂ ਦੀਆਂ ਕਿਤਾਬਾਂ ਲੈਕੇ ਜਾਂਦੇ ਆ ਅਤੇ ਅਲੱਗ ਅਲੱਗ ਮਤਲਬ ਹਰ ਇੱਕ ਉੱਥੇ ਦੇਸ ਦੀਆਂ ਕਹਾਣੀਆਂ ਦੇ ਕੋਈ ਵੀ ਕਿਤਾਬਾਂ ਹਰ ਇੱਕ ਤਰ੍ਹਾਂ ਦੀਆਂ ਕਿਤਾਬਾਂ ਉੱਥੇ ਰੱਖੀਆਂ ਹੁੰਦੀਆਂ ਹਨ ਅਤੇ ਜਿਹਨੂੰ ਜਿਸ ਤਰ੍ਹਾਂ ਦੀ ਕਿਤਾਬ ਚਾਹੀਦੀ ਹੁੰਦੇ ਹਰ ਇੱਕ ਨੌਲੇਜ ਦੀ ਕਿਤਾਬਾਂ ਉੱਥੇ ਪਈਆਂ ਹੁੰਦੇ ਹਨ ਉਹ ਲੈ ਜਾ ਕੇ ਪੜ੍ਹਦੇ ਹਨ ਅਤੇ ਆਪਣਾ ਨੌਲੇਜ ਵਧਾਉਂਦੇ ਹਨ ਅਤੇ ਮੈਨੂੰ ਉਸ ਵਿੱਚ ਸਭ ਤੋਂ ਵਧੀਆ ਕਿਤਾਬ ਸਾਇੰਸ ਦੀ ਲੱਗਦੀ ਹੈ ਅਤੇ ਮੈਂ ਮਤਲਬ ਕਿ ਵਿਗਿਆਨ ਦੀ ਕਿਤਾਬ ਮੈਨੂੰ ਪੜ੍ਹਨ ਨੂੰ ਵਧੀਆ ਲੱਗਦੀ ਹੈ ਕਿ ਇੱਥੇ ਸਾਨੂੰ ਵਿਗਿਆਨ ਦੀ ਸਾਇੰਸ ਬਾਰੇ ਅੱਗੇ ਤੋਂ ਅੱਗੇ ਉਸ ਉਹਦੇ ਨਾਲ ਸਾਨੂੰ ਨੌਲੇਜ ਮਿਲਦੀ ਹੈ ਤਾਂ ਕਿ ਅਸੀਂ ਸਾਨੂੰ ਨੌਲੇਜ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ